ਸਾਰੇ ਹੀ ਧਰਮਾਂ ਦੇ ਲੋਕ ਇਥੇ ਇਕੱਠੇ ਰਹਿ ਕੇ ਆਪਣੇ ਧਰਮ ਦੇ ਜੋ ਵੀ ਫੈਸਟੀਵਲ ਕਲਚਰ ਰਲ ਮਿਲ ਕੇ ਸਾਰੇ ਇਕੱਠੇ ਹੀ ਮਨਾਉਂਦੇ ਹਨ ਇਸ ਕਰਕੇ ਹੀ